ਸਤਿ ਸ਼੍ਰੀ ਅਕਾਲ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਇਹ ਗੁਰੂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਲੋਕ ਅਲੱਗ ਅਲੱਗ ਲੋਕ ਇੱਥੇ ਯਾਤਰਾ ਕਰਨਾ ਬਹੁਤ ਹੀ ਪਸੰਦ ਕਰਦੇ ਹਨ ਇਹ ਇੱਥੇ ਇੱਕ ਨਹੀਂ ਬਹੁਤ ਹੀ ਧਾਰਮਿਕ ਸਥਾਨ ਹਨ ਜਿੱਦਾਂ ਕਿ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਦੇ ਚਾਰ ਰਸਤੇ ਹਨ ਜਾਣ ਲਈ ਉਹ ਇਹ ਦਰਸਾਉਂਦੇ ਹਨ ਕਿ ਅਲੱਗ ਅਲੱਗ ਧਰਮ ਦੇ ਲੋਕ ਇੱਥੇ ਆ ਸਕਦੇ ਹਨ ਹਰਿਮੰਦਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਨੇ ਰੱਖੀ ਸੀ ਜਦੋਂ ਆਪਾਂ ਉੱਥੇ ਜਾਈਏ ਤਾਂ ਬਹੁਤ ਕੁਝ ਹੀ ਸਿੱਖਣ ਨੂੰ ਮਿਲਦਾ ਹੈ ਦੂਸਰਾ ਦੁਰਗਿਆਨਾ ਮੰਦਰ ਜਿਹੜਾ ਬੱਸ ਸਟੈਂਡ ਦੇ ਕੋਲ ਹੀ ਆਉਂਦਾ ਹੈ ਉੱਥੇ ਜਾਈਏ ਤਾਂ ਇੱਕ ਸ਼ਿਵਜੀ ਦੀ ਮੂਰਤੀ ਬੋ ਹੈਗ ਹੈ ਬਹੁਤ ਬਹੁਤ ਹੀ ਵੱਡੀ ਲੱਗੀ ਹੋਈ ਹੈ ਜਿਸ ਨੂੰ ਦੇਖ ਕੇ ਇੱਕ ਦਿਲ ਵਿੱਚ ਬਹੁਤ ਹੀ ਵਧੀਆ ਜਿਹਾ ਅਹਿਸਾਸ ਹੁੰਦਾ ਹੈ ਉੱਥੇ ਘੁੰਮਣ ਲਈ ਵੀ ਬਹੁਤ ਕੁਝ ਹੈ ਹੈ ਤੀਸਰਾ ਗੋਬਿੰਦਗੜ੍ਹ ਸਾਹਿਬ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਸੀ ਉੱਥੇ ਜਾਈ ਜਦੋਂ ਆਪਾਂ ਉੱਥੇ ਘੁੰਮਣ ਜਾਂਦੇ ਹਾਂ ਤਾਂ ਸਾਨੂੰ ਬਹੁਤ ਹੀ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਜਾਣਨ ਨੂੰ ਪਤਾ ਲੱਗਦਾ ਹੈ ਚੌਥਾ ਵਾਹਗਾ ਬਾਰਡਰ ਜਦੋਂ ਆਪਾਂ ਵਾਹਗਾ ਬਾਰਡਰ ਜਾਈਏ ਤਾਂ ਉੱਥੇ ਜਾ ਕੇ ਦਿਲ ਵਿੱਚ ਇੱਕ ਅਲੱਗ ਹੀ ਖੁਸ਼ੀ ਪ੍ਰਦਾਨ ਹੁੰਦੀ ਹੈ ਇੱਕ ਅਲੱਗ ਹੀ ਜੋਸ਼ ਆਉਂਦਾ ਹੈ ਆਪਣੇ ਦੇਸ਼ ਲਈ ਉੱਥੇ ਪਾਕਿਸਤਾਨ ਅਤੇ ਹਿੰਦੁਸਤਾਨ ਬਾਰੇ ਬੋ ਬਹੁਤ ਕੁਝ ਦੱਸਿਆ ਗਿਆ ਹੈ ਜਦੋਂ ਆਪਾਂ ਉੱਥੇ ਜਾਈਏ ਤਾਂ ਹਿੰਦੁਸਤਾਨ ਪਾਕਿਸਤਾਨ ਵਾਲਿਆਂ ਨੂੰ ਅੱਖਾਂ ਦਿਖਾਉਂਦੇ ਹਨ ਔਰ ਪਾਕਿਸਤਾਨ ਹਿੰਦੂ ਹਿੰਦੁਸਤਾਨ ਵਾਲਿਆਂ ਨੂੰ ਅੱਖਾਂ ਦਿਖਾਉਂਦੇ ਹਨ ਜੋ ਕਿ ਉਹਨਾਂ ਦਾ ਜੋਸ਼ ਦੇਖਦੇ ਹਾਂ ਦੇਖਦੇ ਹਾਂ ਆਪਾਂ ਜਦੋਂ ਹਿੰਦੁਸਤਾਨ ਦਾ ਇੱਕ ਸੈਨਿਕ ਉੱਥੇ ਅਲੱਗ ਅਲੱਗ ਕਰਤੱਵ ਦਿਖਾਉਂਦਾ ਹੈ ਤਾਂ ਉਹਨਾਂ ਵੱਲ ਦੇਖ ਕੇ ਦਿਲ ਵਿੱਚ ਇੱਕ ਅਲੱਗ ਹੀ ਜੋਸ਼ ਪੈਦਾ ਹੁੰਦਾ ਹੈ ਆਪਣੇ ਦੇਸ਼ ਲਈ ਕਿ ਜ ਜਦੋਂ ਜਿੱਦਾਂ ਇਹ ਆਪਣੇ ਦੇਸ਼ ਲਈ ਇੰਨਾ ਕੁਝ ਕਰ ਰਹੇ ਹਾਂ ਤਾਂ ਸਾਨੂੰ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਆਪਾਂ ਕਿਉਂ ਪਿੱਛੇ ਹਟੀਏ ਹਾਂਜੀ ਧੰਨਵਾਦ ਜੀ